ਪੰਜਾਬੀ ਭਾਸ਼ਾ ਹੋਰ ਭਾਸ਼ਾਵਾਂ ਜਿਵੇਂ ਕਿ ਸੰਸਕ੍ਰਿਤ ਜਾਂ ਅੰਗਰੇਜ਼ੀ ਦੁਆਰਾ ਇਸ ਤਰ੍ਹਾਂ ਪਰਿਭਾਸ਼ਿਤ ਹੋਵੇਗੀ ਪੰਜਾਬੀ ਦਾ ਇੱਕ ਪੰਜਾਬੀ ਭਾਸ਼ਾ ਦਾ ਇੱਕ ਆਪਣਾ ਸੱਭਿਆਚਾਰਕ ਔਰ ਇਤਿਹਾਸਿਕ ਵਰਤਾਰਾ ਸੀ ਪੰਜਾਬੀ ਭਾਸ਼ਾ ਇਸ ਕਰਕੇ ਪ੍ਰਭਾਵਿਤ ਹੋਈ ਕਿਉਂਕਿ ਅੰਗਰੇਜ਼ੀ ਭਾਸ਼ਾ ਜਾਂ ਸੰਸਕ੍ਰਿਤ ਭਾਸ਼ਾ ਦੋਵੇਂ ਭਾਸ਼ਾਵਾਂ ਬਹੁਤ ਵਿਕਸਿਤ ਸਨ ਅਤੇ ਪੰਜਾਬੀ ਭਾਸ਼ਾ ਨੂੰ ਵੀ ਇਸ ਤਰ੍ਹਾਂ ਸਿੱਖਾਂ ਦੁਆਰਾ ਅਤੇ ਹੋਰ ਇਤਿਹਾਸਿਕ ਗੁਰੂਆਂ ਗੁਰੂਆਂ ਦੁਆਰਾ ਪਰਿਭਾਸ਼ਿਤ ਕੀਤਾ ਗਿਆ